ਬਿਜਲੀ ਸਾਡੇ ਰਹਿਣ ਸਹਿਣ ਲਈ ਬਹੁਤ ਜ਼ਜਰੂਰੀ ਹੈ ਪਰ ਇਸ ਦੇ ਕਾਫੀ ਖ਼ਤਰੇ ਵੀ ਹਨ ਜਿਹਨੂੰ ਸਾ ਜਿਹਦੇ ਕੋਲੋਂ ਸਾਨੂੰ ਸੁ ਸੁਚੇਤ ਰਹਿਣਾ ਚਾਹੀਦਾ ਹੈ ਜਿਵੇਂ ਕਿ ਜਦੋਂ ਜ਼ਿਆਦਾ ਟਾਈਮ ਦੇ ਲਈ ਹੈਵੀ ਇਕਿਉਪਮੈਂਟ ਚਲਦੇ ਹਨ ਅਤੇ ਕਈ ਵਾਰ ਤਾਰ ਗਰਮ ਹੋ ਕੇ ਉਹ ਸੜ ਜਾਂਦੀ ਹੈ ਉਹ ਸਰੀਕ ਉਹਨਾਂ ਚੀਜ਼ਾਂ ਤੋਂ ਬਚਣ ਲਈ ਸਾਨੂੰ ਆਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੀ ਉਹ ਤਾਰ ਹੈਗੀ ਹੈ ਉਹ ਉਸ ਤਾਰ ਨੂੰ ਲੋਡ ਨੂੰ ਸਹਿਣਯੋਗ ਕਿਵੇਬਿਲਿਟੀ ਰੱਖਦੀ ਹੈ ਕਿ ਨਹੀਂ ਜੇ ਨਹੀਂ ਤਾਂ ਸਾਨੂੰ ਉਸ ਨੂੰ ਜ਼ਿਆਦਾ ਟਾਈਮ ਤੱਕ ਵਰਤਣਾ ਨਹੀਂ ਚਾਹੀਦਾ ਦੂਜਾ ਜਿਵੇਂ ਕਿ ਜਿੰਨੀਆਂ ਵੀ ਤਾਰਾਂ ਬਾਹਰ ਰੋਡ 'ਤੇ ਹੁੰਦੀਆਂ ਹਨ ਉਹ ਸਾਰੀਆਂ ਨੰਗੀਆਂ ਹਨ ਅਤੇ ਕਦੀ ਕਦੀ ਕਈ ਵਾਰ ਗਲਤੀ ਦੇ ਨਾਲ ਸਾਡਾ ਹੱਥ ਜਾਂ ਹੋਰ ਧਾਤੂ ਦੇ ਅੰਗ ਉੱਥੇ ਲੱਗ ਜਾਣ ਤਾਂ ਉਹ ਕਰੰਟ ਸਾਡੇ ਘਰ 'ਤੇ ਘਰ ਜਾਂ ਸਾਡੇ ਉੱਤੇ ਡਿੱਗ ਸਕਦਾ ਹੈ ਜਿਸ ਨੂੰ ਅਸੀਂ ਇੰਸੂਲੇਸ਼ਨ ਤਾਰਾਂ ਦੇ ਨਾਲ ਬਚਾ ਸਕਦੇ ਹਾਂ ਇਸ ਤਰੀਕੇ ਨਾਲ ਬਿਜਲੀ ਦੇ ਕਈ ਘਾਟੇ ਵੀ ਹਨ ਪਰ ਜ਼ਿਆਦਾਤਰ ਸਾਨੂੰ ਇਸ ਨੂੰ ਅਪਣਾ ਕੇ ਇਸ ਨੂੰ ਵਧੀਆ ਤਰ੍ਹਾਂ ਦਾ ਇੱਕ ਵਰਤਣਾ ਚਾਹੀਦਾ ਹੈ